ਵੈਸੇ ਤਾਂ ਮੈਨੂੰ ਘੁੰਮਣ ਦਾ ਬਹੁਤ ਜਿਆਦਾ ਸ਼ੌਂਕ ਹੈਗਾ ਏ ਜਿੱਦਾਂ ਹੁਣ ਮੈਂ ਅਕਸਰ ਹੀ ਘੁੰਮਦਾ ਰਹਿੰਦਾ ਹੈਗਾ ਆਲੇ ਦੁਆਲੇ ਆਪਣੇ ਜਿੱਦਾਂ ਨਵੀਂਆਂ ਨਵੀਂਆਂ ਥਾਂ 'ਤੇ ਜਾਣਾ ਜਿਹੜੀ ਵਧੀਆ ਹੋਵੇ ਰੋਚਕ ਥਾਵਾਂ 'ਤੇ ਉੱਥੇ ਜਾਣਾ ਅਤੇ ਨਵੇਂ ਨਵੇਂ ਬੰਦਿਆਂ ਨਾਲ ਮਿਲਣਾ ਇਹ ਮੈਨੂੰ ਬੜਾ ਵਧੀਆ ਲੱਗਦਾ ਹੈਗਾ ਏ ਮੈਂ ਪਿੱਛੇ ਜਿਹੇ ਦਰਬਾਰ ਸਾਹਿਬ ਗਿਆ ਸੀਗਾ ਉਹ ਜਿੱਥੇ ਜਿਸਦਾ ਉਹਦੇ ਬਾਰੇ ਕਿਹਾ ਜਾਂਦਾ ਹੈਗਾ ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ ਹੈਂ ਇੱਦਾਂ ਹੈਗਾ ਉਹਦੇ ਬਾਰੇ ਕਿਹਾ ਗਿਆ ਉੱਥੇ ਇੱਕ ਗੋਲਡਨ ਟੈਂਪਲ ਹੈਗਾ ਜਿਹੜਾ ਸਿੱਖਾਂ ਦੇ ਚੌਥੇ ਗੁਰੂ ਹੈਗੇ ਉਹਨਾਂ ਨੇ ਉਸਾਰੀ ਸ਼ੁਰੂ ਕਰਵਾਈ ਸੀਗੀ ਅਤੇ ਪੰਜਵੇਂ ਗੁਰੂ ਨੇ ਉਹਨਾਂ ਦੀ ਉਸਾਰੀ ਪੂਰੀ ਕਰਵਾਈ ਸੀਗੀ ਉੱਥੇ ਇੱਕ ਮਤਲਬ ਸਰੋਵਰ ਹੈਗਾ ਸਰੋਵਰ ਦੇ ਸੈਂਟਰ ਵਿੱਚ ਇੱਕ ਗੱਭੇ ਇੱਕ ਉਹਨਾਂ ਦਾ ਮੰਦਰ ਹੈਗਾ ਸਿੱਖ ਧਰਮ ਦਾ ਉਹਦੇ ਵਿੱਚ ਸ਼ ਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਏ ਉੱਥੇ ਸਵੇਰ ਸ਼ਾਮ ਉੱਥੇ ਪਾਠ ਚਲਦਾ ਰਹਿੰਦਾ ਹੈਗਾ ਉੱਥੇ ਲੰਗਰ ਵੀ ਚੱਲਦਾ ਰਹਿੰਦਾ ਹੈਗਾ ਏ ਮੈਂ ਉੱਥੇ ਆਪਣੀ ਫੈਮਿਲੀ ਨਾਲ ਗਿਆ ਸੀਗਾ ਘੁੰਮਣ ਵਾਸਤੇ ਅਤੇ ਉੱਥੇ ਗੋਲਡਨ ਟੈਂਪਲ ਦੇਖਣ ਵਾਸਤੇ ਗਿਆ ਸੀਗਾ ਕਿਉਂਕਿ ਉੱਥੇ ਜਿਹੜਾ ਗੋਲਡਨ ਟੈਂਪਲ ਉਹਦਾ ਨਾਂ ਤਾਂ ਪਿਆ ਹੈਗਾ ਏ ਉੱਥੇ ਜਿਹੜਾ ਉਹਦੀਆਂ ਜਿਹੜਾ ਸਰੋਵਰ ਦੇ ਗੱਭੇ ਜਿੱਦਾਂ ਤੁਹਾਨੂੰ ਮੈਂ ਦੱਸਿਆ ਸੀਗਾ ਸਰੋਵਰ ਦੇ ਗੱਬਾ ਜਿਹੜਾ ਮੰਦਰ ਹੈਗਾ ਏ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਏ ਉਹਦੇ 'ਤੇ ਨਾ ਸੋਨੇ ਦੀਆਂ ਪਰਤਾਂ ਚੜ੍ਹੀਆਂ ਹੋਈਆਂ ਹੋਈਆਂ ਏ ਉਹ ਸੋਨੇ ਦੀਆਂ ਪਰਤਾਂ ਮੈਨੂੰ ਉੱਥੇ ਜਾ ਕੇ ਪਤਾ ਲੱਗਿਆ ਵੀ ਜਿਹੜਾ ਜਿੱਦਾਂ ਮੈਂ ਕਿਸੇ ਤੋਂ ਪੁੱਛਿਆ ਵੀ ਇੰਨਾਂ ਸੋਨਾ ਮੈਂ ਕਿਹਨੇ ਦਾਨ ਕਰ ਦਿੱਤਾ ਇਹ ਮੈਨੂੰ ਉੱਥੇ ਇੱਕ ਸਿੱਖ ਨੇ ਦੱਸਿਆ ਸੀਗਾ ਜਿਹੜਾ ਸੇਵਾਦਾਰ ਸੀਗਾ ਵੀ ਉਹ ਜਿਹੜਾ ਸੋਨੇ ਦੇ ਸੋਨਾ ਸੀਗਾ ਇਹ ਕਰੀ ਬਹੁਤ ਜ਼ਿਆਦਾ ਸੋਨਾ ਢਾਈ ਸੌ ਕਿਲੋ ਦੇ ਕਰੀਬ ਸੋਨਾ ਸੀਗਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਅਤੇ ਉਹਨਾਂ ਦੀ ਸੱਸ ਜਿਹੜੀ ਸਦਾ ਕੌਰ ਹੈਗੀ ਸੀਗੀ ਉਹਨਾਂ ਨੇ ਦਾਨ ਕੀਤਾ ਸੀਗਾ ਇਹ ਇੱਥੇ ਇਹਦੇ ਵਾਸਤੇ ਇਸ ਕਰਕੇ ਮੈਨੂੰ ਉੱਥੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਮੈਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਭਾਗਸ਼ਾਲੀ ਸਮਝਦਾ ਹੈਗਾ ਵੀ ਇੱਦਾਂ ਦੀ ਜਗ੍ਹਾ 'ਤੇ ਮੈਨੂੰ ਜਾਣ ਦਾ ਮੌਕਾ ਮਿਲਿਆ ਹੈਗਾ ਏ ਫੈਮਿਲੀ ਨਾਲ ਮਿਲਿਆ ਹੈਗਾ ਏ ਆਪਾਂ ਉੱਥੇ ਬਹੁਤ ਜ਼ਿਆਦਾ ਮਤਲਬ ਉੱਥੇ ਜਾ ਕੇ ਆਨੰਦ ਮਾਣਿਆ ਬਹੁਤ ਜ਼ਿਆਦਾ ਵਧੀਆ ਲੱਗਿਆ ਉਹਦੇ ਨਾਲ ਜਲ੍ਹਿਆਂਵਾਲਾ ਬਾਗ ਵੀ ਹੈਗਾ ਏ ਉਹਦੇ ਬਾਰੇ ਵੀ ਉਹ ਉੱਨੀ ਸੌ ਉੱਨੀ ਵਿੱਚ ਉਸ ਵਿਸਾਖੀ ਦੇ ਵੇਲੇ ਅੰਗਰੇਜ਼ਾਂ ਨੇ ਮਤਲਬ ਨਿਹੱਥੇ ਲੋਕਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਸੀਗੀਆਂ ਇਸ ਕਰਕੇ ਮੈਨੂੰ ਇੱਥੇ ਯਾਤਰਾ ਕਰਕੇ ਬਹੁਤ ਜ਼ਿਆਦਾ ਆਨੰਦ ਆਇਆ ਅਤੇ ਬਹੁਤ ਜ਼ਿਆਦਾ ਚੀਜ਼ਾਂ ਸਿੱਖਣ ਨੂੰ ਮਿਲੀਆਂ